ਹੈਲੋ ਨਮਸਤੇ ਮੈਮ ਹਾਂਜੀ ਓਕੇ ਜੀ ਓਕੇ ਓਕੇ ਮੈਮ ਹਾਂਜੀ

ਹਾਂਜੀ ਮੈਂ ਕ ਕਪੂਰਥਲੇ ਵਿੱਚ ਹੀ ਰਹਿੰਦੀ ਹਾਂ ਅਤੇ ਮੇਰੀ ਬੇਟੀ ਐਮ ਜੀ ਐਨ ਪਬਲਿਕ ਸਕੂਲ ਵਿੱਚ ਪੜ੍ਹਦੀ ਹੈ ਜੋ ਅਜੀਤ ਨਗਰ ਕਪੂਰਥਲਾ ਵਿੱਚ ਹੈ ਅਤੇ ਮੈਮ ਇਹ ਸਕੂਲ ਬਹੁਤ ਵਧੀਆ ਇਹ ਇਹ ਸੀ ਬੀ ਐਸ ਈ ਦੇ ਨਾਲ ਲਿੰਕ ਹੈ ਇਹ ਸਕੂ ਅਤੇ ਇਹ ਸਕੂਲ ਦਾ ਫੀਸ ਸਟਰਕਚਰ ਵੀ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈ ਮੀਨਜ ਹਰ ਇੱਕ ਮਿਡਲ ਕਲਾਸ ਬੰਦਾ ਵੀ ਇਸ ਨੂੰ ਇਸ ਵਿੱਚ ਆਪਣਾ ਬੱਚਾ ਪੜ੍ਹਾ ਸਕਦਾ ਹਾਂਜੀ ਅਤੇ ਮੈਮ ਇਸਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਸਾਨੂੰ ਬੱਚਿਆਂ ਨੂੰ ਹੋਰ ਵੀ ਜਿਵੇਂ ਕਿ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਕੰਮ ਕਰਵਾਇਆ ਜਾਂਦਾ ਹੈ ਹਾਂਜੀ ਮੈਮ

ਹਾਂਜੀ ਮੈਮ ਸਪੋਰਟਸ ਵਾਸਤੇ ਇਹ ਸਕੂਲ ਪੂ ਪੂਰੇ ਕਪੂਰਥਲੇ ਵਿੱਚ ਐਮ ਜੀ ਐਨ ਸਕੂਲ ਨੰਬਰ ਵਨ ਦੇ ਉੱਤੇ ਹੈ ਅਤੇ ਇਹ ਬੱਚਿਆਂ ਨੂੰ ਡਿਸਟਰਿਕਟ ਲੈਵਲ ਦੇ ਉੱਤੇ ਸਟੇਟ ਲੈਵਲ ਦੇ ਉੱਤੇ ਗੇਮ ਖੇਡਣ ਦੇ ਵਿੱਚ ਬਹੁਤ ਵਧੀਆ ਨੇ ਅਤੇ ਇਹਨਾਂ ਦੇ ਵਿੱਚ ਇਨ ਇਸ ਸਕੂਲ ਦੇ ਵਿੱਚੋਂ ਵੀ ਕਿੰਨੇ ਹੀ ਬੱਚੇ ਮੈਮ ਲਾਸਟ ਤੋਂ ਪਿਛਲੇ ਦਸ ਸਾਲਾਂ ਤੋਂ ਸਟੇਟ ਲੈਵਲ ਦੇ ਉੱਤੇ ਗੇਮ ਖੇਡ ਚੁੱਕੇ ਨੇ ਅਤੇ ਬਹੁਤ ਵਧੀਆ ਸਕੂਲ ਹੈ ਮੈਮ ਸਪੋਰਟਸ ਦੇ ਨਾਲ ਨਾਲ ਇਸ ਬੱਚਿਆਂ ਨੂੰ ਹੋਰ ਵੀ ਕਈ ਤਰੀਕੇ ਦੇ ਕੰਮ ਸਿਖਾਉਂਦੇ ਨੇ ਜਿਵੇਂ ਕਿ ਆਰਟ ਹੋ ਗਈ ਬੱਚਿਆਂ ਨੂੰ ਹੋਰ ਵੀ ਜੋ ਜ ਗਾਰਡਨਿੰਗ ਹੋ ਗਈ ਬੱਚਿਆਂ ਨੂੰ ਬੂਟੇ ਲਗਾਉਣੇ ਸਬਜ਼ੀਆਂ ਕਿਵੇਂ ਉਗਾਈਆਂ ਜਾਂਦੀਆਂ ਹੋਰ ਬਹੁਤ ਤਰੀਕੇ ਦੇ ਕੰਮ ਨੇ ਡਰਾਇੰਗ ਹੁੰਦੀ ਹੈ ਬੱਚੇ ਨੇ ਡਾਂਸ ਕਿਵੇਂ ਕਰਨਾ ਬਹੁਤ ਸਾਰੇ ਤਰੀਕੇ ਦੇ ਡਰਾਇੰਗ ਹੋ ਗਈ ਓ ਆਰਟ ਦੇ ਵਿੱਚ ਇਹ ਸਕੂਲ ਨੰਬਰ ਵਨ 'ਤੇ ਹੈ ਪੂਰੇ ਕਪੂਰਥਲੇ ਵਿੱਚ ਫੋਰਥ ਸਟੈਂਡਰਡ ਵਿੱਚ ਚੌਥੀ ਕਲਾਸ ਵਿਚ ਪੜ੍ਹਦੇ ਨੇ ਹਾਂਜੀ ਮੈਮ ਉਹ ਫੁਟਬਾਲ ਕਰਦੇ ਹੈ ਇਸ ਦੇ ਨਾਲ ਮੈਮ ਹਾਂਜੀ ਮੈਮ ਇਸ ਦੇ ਨਾਲ ਇੱਕ ਹੋਰ ਸਕੂਲ ਵੀ ਹੈ ਸਾਡੇ ਕਪੂਰਥਲੇ ਦੇ ਵਿੱਚ ਉਹਦਾ ਨਾਮ ਹੈ ਡੀ ਆਈ ਪੀ ਐਸ ਸਕੂਲ ਕਪੂਰਥਲਾ ਇਹ ਅਰਬਨ ਸਟੇਟ ਕਪੂਰਥਲੇ ਵਾਲੀ ਸਾਈਡ ਇਹਦਾ ਸਕੂਲ ਹੈ ਇਹ ਵੀ ਸੀ ਬੀ ਐਸ ਈ ਸਕੂਲ ਹੈ ਵੀ ਸਕੂਲ ਬੱਚਿਆਂ ਦੇ ਵਾਸਤੇ ਬਹੁਤ ਵਧੀਆ ਹੈ ਮੈਮ ਤੁਸੀਂ ਆਪਣੇ ਏਰੀਆ ਦੇ ਹਿਸਾਬ ਦੇ ਨਾਲ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ ਤੁਸੀਂ ਸ਼ਿਫਟ ਹੋਏ ਹੋ ਹਿਸਾਬ ਦੇ ਨਾਲ ਤੁਸੀਂ ਆਪਣਾ ਨੋਟ ਕਰਕੇ ਕਿ ਤੁਹਾਨੂੰ ਕਿਹੜਾ ਦੂਰੀ 'ਤੇ ਜ਼ਿਆਦਾ ਨਾ ਪਵੇ ਉਹ ਸਕੂਲ ਦੇ ਵਿੱਚੋਂ ਦੇਖ ਸਕਦੇ ਹੋ ਇੱਕ ਡੀ ਆਈ ਪੀ ਸਕੂਲ ਬਹੁਤ ਵਧੀਆ ਇੱਕ ਸੈਨਿਕ ਸਕੂਲ ਕਪੂਰਥਲੇ ਵਿੱਚ ਹੈ ਉਹ ਵੀ ਬਹੁਤ ਵਧੀਆ ਸਕੂਲ ਮੰਨਿਆ ਜਾਂਦਾ ਸੀ ਬੀ ਐਸ ਈ ਲਈ ਬੱਚਿਆਂ ਲਈ ਇਹਨਾਂ ਤਿੰਨਾਂ ਸਕੂਲਾਂ ਦਾ ਫੀਸ ਦਾ ਜਿਹੜਾ ਸਿਸਟਮ ਹੈ ਮੈਮ ਬਹੁਤ ਵਧੀਆ ਹੈ ਬਹੁਤ ਘੱਟ ਫੀਸ ਦੇ ਵਿੱਚ ਬੱਚਿਆਂ ਨੂੰ ਵਧੀਆ ਪੜ੍ਹਾਈ ਦਿੰਦੇ ਨੇ ਅਤੇ ਇੱਥੇ ਦਾ ਜਿਹੜਾ ਸਟਾਫ ਹੈ ਟੀਚਰਾਂ ਨੇ ਪ੍ਰਿੰਸੀਪਲ ਨੇ ਸਾਰੇ ਬਹੁਤ ਵਧੀਆ ਨੇ ਅਤੇ ਤਿੰਨਾਂ ਸਕੂਲ ਹਾਂਜੀ ਹਾਂਜੀ ਮੈਮ ਜੋ ਜੀ ਮੈਮ ਜੋ ਐਮ ਜੀ ਐਮ ਸਕੂਲ ਹੈ ਉਹਦੇ ਵਿੱਚ ਮੇਰੇ ਬੱਚੇ ਬੱਸ ਦੇ ਨਾਲ ਹੀ ਜਾਂਦੇ ਨੇ ਬੱਸ ਵਿੱਚ ਹੀ ਆਉਂਦੇ ਨੇ ਉਸਦੇ ਜਿਹੜੇ ਪੈਸੇ ਨੇ ਹਾਂਜੀ ਉਹ ਤੁਹਾਡੇ ਏਰੀਆ ਦੇ ਹਿਸਾਬ ਦੇ ਨਾਲ ਤੁਹਾਨੂੰ ਥੋ ਬੱਚਿਆਂ ਦੇ ਬੱਸ ਦਾ ਟਾਈਮ ਜਿਹੜਾ ਹੈ ਉਹ ਸਕੂਲ ਹੀ ਦੱਸੇਗਾ ਅਤੇ ਸਕੂਲ ਦੇ ਵਿੱਚ ਹੀ ਤੁਹਾਨੂੰ ਬੱਚਿਆਂ ਨੂੰ ਡਰੈਸਾਂ ਅਤੇ ਬੁੱਕਸ ਵੀ ਮਿਲਦੀਆਂ ਨੇ ਉਸੀ ਹਿਸਾਬ ਦੇ ਨਾਲ ਤੁਸੀਂ ਆਪਣਾ ਕਰ ਸਕਦੇ ਹੋ ਅਤੇ ਬੱਚਿਆਂ ਨੂੰ ਹੋਰ ਵੀ ਪੇਪਰਾਂ ਵਿੱਚ ਵੀ ਐਕਸਟਰਾ ਪੜ੍ਹਾਇਆ ਜਾਂਦਾ ਹਾਂਜੀ ਇਸ ਤੋਂ ਇਲਾਵਾ ਮੈਮ ਇੱਕ ਹੋਰ ਵੀ ਸਕੂਲ ਹੈ ਜੀ ਪੀ ਟੀ ਇੰਟਰਨੈਸ਼ਨਲ ਸੀਨੀਅਰ ਸੈਕੈਂਡਰੀ ਸਕੂਲ ਪਰ ਮੈਮ ਇਹ ਥੋੜ੍ਹਾ ਜਿਹਾ ਦੂਰ ਪੈ ਜਾਂਦਾ ਅਤੇ ਤਾਂ ਮੈਨੂੰ ਇਹਦੇ ਨਾਲੋਂ ਬੈਟਰ ਤਾਂ ਐਮ ਜੀ ਐਨ ਵੀ ਹੈਗਾ ਆਪਣਾ ਡਿਪਸ ਵੀ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਡੀ ਆਈ ਪੀ ਐਸ ਸਕੂਲ ਕਪੂਰਥਲਾ ਇੱਕ ਸੈਨਿਕ ਸਕੂਲ ਵੀ ਹੈਗਾ ਮੈਮ ਇਹ ਤਿੰਨੋਂ ਬਹੁਤ ਵਧੀਆ ਸਕੂਲ ਨੇ ਤੁਸੀਂ ਇਹਨਾਂ ਵਿੱਚੋਂ ਦੀ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿਹਦੀ ਫੀਸ ਤੁਹਾਨੂੰ ਵਧੀਆ ਲੱਗਦੀ ਹੈ ਅਤੇ ਬਾਕੀ ਇਹ ਤਿੰਨ ਸਕੂਲ ਬਹੁਤ ਵਧੀਆ ਨੇ ਹਾਂਜੀ ਹੰ ਹਾਂਜੀ ਮੈਮ ਉਹ ਤੁਹਾਨੂੰ ਪੂਰਾ ਸਕੂਲ ਦਿਖਾਉਣ ਵਿੱਚ ਬਹੁਤ ਹੈਲਪਫੁਲ ਨੇ ਤ ਤਿੰਨੋਂ ਸਕੂਲ ਬਹੁਤ ਵਧੀਆ ਨੇ ਓਕੇ ਮੈਮ ਓਕੇ ਮੈਮ